ਹੈਲੋ ਹਾਂਜੀ ਹਾਂਜੀ ਮੈਂ ਉੱਥੋਂ ਬੋਲ ਰਿਹਾਂ ਹਾਂਜੀ ਅਤੇ ਤੁਸੀਂ ਚੈੱਕ ਕਰਕੇ ਨਹੀਂ ਲਈ ਸੀ ਅੱਛਾ ਅਤੇ ਦੇਖੋ ਹੁਣ ਦੇਖੋ ਅਸੀਂ ਤਾਂ ਤੁਹਾਨੂੰ ਸਾਰਾ ਮਾਲ ਚੈੱਕ ਕਰਵਾ ਕੇ ਹੀ ਦਿੱਤਾ ਸੀ ਅਤੇ ਹੁਣ ਉਹ ਘਰ ਜਾ ਕੇ ਟੁੱਟ ਗਈ ਸ਼ਾਇਦ ਤੁਹਾਡੇ ਕੋਲੋਂ ਗਲਤੀ ਨਾਲ ਟੁੱਟ ਗਈ ਹੋਵੇ ਜੀ ਮਾਲ ਤਾਂ ਗਰੰਟੀ ਦਾ ਹੀ ਸੀ ਦੇਖੋ ਜੀ ਕ ਕੰਪਨੀ ਦੀ ਕ ਦਿੱਤੀ ਸੀ ਮੈਂ ਤੁਹਾਨੂੰ ਮੈਂ ਕਿਹਾ ਚੱਲ ਦਿਖਾਈ ਵੀ ਸੀ ਉਸ ਟਾਈਮ ਸਹੀ ਵੀ ਸੀ ਸਾਰਾ ਕੁਛ ਦੇ ਦੇਖੋ ਹੁਣ ਐਕਸਚੇਂਜ ਕੀ ਦਾਂ ਹੁਣ ਪਹਿਲਾਂ ਤੁਸੀਂ ਦੇਖੀ ਸੀ ਕੀ ਐਕਸਚੇਂਜ ਕਰੀਏ ਉਨ੍ਹਾਂ 'ਚ ਨਹੀਂ ਜੀ ਅਸੀਂ ਕੰਪਨੀ ਦੀ ਦਿੱਤੀ ਸੀ ਅੱਛਾ ਕੰਪਨੀ ਦੀ ਕ ਦੇ ਦਿੱਤੀ ਸੀ ਤੁਸੀਂ ਆਪ ਦੇਖੋ ਉੱਥੇ ਲੋਗੋ ਲੱਗਿਆ ਕੰਪਨੀ ਦਾ ਜਿਹੜੀ ਕੰਪਨੀ ਲੈ ਕੇ ਗਏ ਸੀ ਤੁਸੀਂ ਚੱਲ ਲੇ ਆਓ ਫਿਰ ਦੇਖਾਂਗੇ ਕਿ ਉਨ੍ਹਾਂ ਦਾ ਹੈ ਕੇ ਨਹੀਂ ਫਿਰ ਮੈਂ ਕੰਪਨੀ ਜੋ ਭੇਜਾਂਗਾ ਨਾ ਫਿਰ ਤੁਹਾਨੂੰ ਦੱਸਾਂਗਾ ਕਿ ਐਕਸਚੇਂਜ ਹੋ ਪਾਵੇਗੀ ਕਿ ਨਹੀਂ ਇਸ 'ਚ ਹੁਣ ਪੰਜ ਛੇ ਦਿਨ ਤਾਂ ਚਲੇ ਹੀ ਜਾਣਗੇ ਜੀ ਤੁਸੀਂ ਇੱਕ ਵਾਰ ਉਹਨੂੰ ਲੈ ਕੇ ਆ ਜਾਓ ਸਪੈਸਕ ਅਤੇ ਐਨਕ ਨੂੰ ਅਤੇ ਫਿਰ ਦੇਖਦੇ ਹਾਂ ਮੈਂ ਗੱਲ ਕਰੂ ਤੁਹਾਡੇ ਸਾਹਮਣੇ ਹੀ ਗੱਲ ਕਰ ਲਵਾਂਗਾ ਅਤੇ ਫਿਰ ਵੇਖਦੇ ਹਾਂ ਕੰਪਨੀ ਵਾਲੇ ਕੀ ਕਹਿੰਦਾ ਹਾਂਜੀ ਕਹਿ ਦੇਵਾਂਗਾ ਨਾ ਮੈਂ ਆਪਣੇ ਵਲੋਂ ਤਾਂ ਕੱਲ੍ਹ ਨੂੰ ਕਹਿ ਦੇਵਾਂਗਾ ਕਿ ਥੋੜ੍ਹਾ ਜਲਦੀ ਦਿਓ ਦੋ ਦਿਨਾਂ ਵਿੱਚ ਹੀ ਕਰ ਦੇਣ ਐਕਸਚੇਂਜ ਜੇ ਮੰਨ ਗਿਆ ਤਾਂ ਦੇਖੋ ਹੁਣ ਕਿੱਥੋਂ ਆਉਂਦੀ ਚੀਜ਼ ਦੇਖੋ ਐਵੇਂ ਤਾਂ ਨਹੀਂ ਉਸ ਦਿਨ ਤੁਹਾਨੂੰ ਵੀ ਤਾਂ ਲੋਸ ਹੁੰਦਾ ਹੀ ਹੈ ਫਿਰ ਅੱਛਾ ਠੀਕ ਹੈ ਫਿਰ ਲੈ ਕੇ ਆ ਜਾਓ ਮੈਂ ਆਪਣੇ ਵਲੋਂ ਦੇ ਦੂੰਗਾ ਗਾ ਇੱਕ ਵਾਰ ਅਤੇ ਫਿਰ ਬਾਅਦ 'ਚ ਮੈਂ ਐਕਸਚੇਂਜ ਕਰ ਲਊਂ ਕੰਪਨੀ ਤੋਂ ਠੀਕ ਹੈ ਜੀ ਓਕੇ ਜੀ